ਬਚਪਨ ਦੀਆਂ ਬਹੁਤ ਮਨਮੋਹਕ ਯਾਦਾਂ ਹਨ ਜਿਨ੍ਹਾਂ ਨਾਲ਼ ਮੇਰਾ ਜੀਵਨ ਬਹੁਤ ਹੀ ਖ਼ਾਸ ਬਣ ਜਾਂਦਾ ਹੈ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਸਨ ਅਸੀਂ ਇਕੱਠੇ ਖੇਡਦੇ ਹੁੰਦੇ ਸਾਂ ਅਤੇ ਦੌੜਾਂ ਲਾਉਂਦੇ ਹੁੰਦੇ ਸਾਂ ਕਦੇ ਲੁਕਣ ਮਿਚੀ ਖੇਡਦੇ ਸਾਂ ਇਹ ਚੀਜ਼ਾਂ ਮੈਨੂੰ ਅਜੇ ਤੱਕ ਯਾਦ ਨੇ ਇਹਨਾਂ ਨਾਲ਼ ਮੇਰੀ ਜ਼ਿੰਦਗੀ ਬਹੁਤ ਸੁਹਾਵਣੀ ਬਣ ਗਈ ਹੈ ਜਦੋਂ ਵੀ ਮੈਂ ਆਪਣੇ ਦੋਸਤਾਂ ਬਾਰੇ ਸੋਚਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ